ਇੱਕ ਵਾਰ ਦੀ ਗੱਲ ਹੈ ਮੈਂ ਸੋਚਿਆ ਇੱਕ ਔਨਲਾਈਨ ਕਰੀਮ ਮੰਗਵਾਈ ਜਾਵੇ ਇਸ ਲਈ ਮੈਂ ਉਹ ਪ੍ਰੋਡਕਟ ਔਨਲਾਈਨ ਔਡਰ ਕੀਤਾ ਅਤੇ ਜਿਹੜਾ ਉਹ ਔਡਰ ਸੀ ਉਹ ਪਹਿਲਾਂ ਹੀ ਇੱਕ ਹਫ਼ਤਾ ਮੇਰੇ ਕੋਲ ਲੇਟ ਆਇਆ ਸੀ ਅਤੇ ਫਿਰ ਉਸ ਉਸ ਤੋਂ ਬਾਅਦ ਜਦੋਂ ਮੈਂ ਉਹ ਪ੍ਰੋਡਕਟ ਨੂੰ ਯੂਜ ਕੀਤਾ ਉਹ ਪ੍ਰੋਡਕਟ ਯੂਜ ਕਰਨ ਤੋਂ ਬਾਅਦ ਮੇਰੇ ਫੇਸ ਸਕਿਨ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ ਮੇਰੀ ਫੇਸ 'ਤੇ ਮਤਲਬ ਬਹੁਤ ਹੀ ਜ਼ਿਆਦਾ ਕਿਲਜ ਹੋ ਗਏ ਸੀ ਇਸ ਲਈ ਮਤਲਬ ਫਿਰ ਮੈਂ ਡਾਕਟਰਾਂ ਕੋਲ ਗਈ ਫਿਰ ਉਹਨਾਂ ਨੇ ਮੈਨੂੰ ਦਵਾਈਆਂ ਦਿੱਤੀਆਂ ਜੋ ਕਿ ਮਤਲਬ ਫਿਰ ਮੈਨੂੰ ਪਤਾ ਲੱਗਿਆ ਉਹਦਾ ਮੈਨੂੰ ਸਾਈਡ ਇਫੈਕਟ ਹੋ ਗਿਆ ਸੀ ਅਤੇ ਉਹ ਫਿਰ ਮੈਂ ਦੇਖ ਕੇ ਬਹੁਤ ਹੀ ਜ਼ਿਆਦਾ ਨਿਰਾਸ਼ ਹੋਈ ਉਦੋਂ ਮਤਲਬ ਮੈਂ ਇੰਨਾ ਜ਼ਿਆਦਾ ਡਾਕਟਰਾਂ ਕੋਲ ਗਈ ਫਿਰ ਮੈਂ ਉੱਥੋਂ ਦਵਾਈਆਂ ਲਈਆਂ ਅਤੇ ਮੇਰਾ ਬਹੁਤ ਹੀ ਜ਼ਿਆਦਾ ਬੈਡ ਐਕਸਪੀਰੀਅੰਸ ਰਿਹਾ ਹੈ ਉਸ ਕਰੀਮ ਦਾ ਅਤੇ ਫਿਰ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਉਹੋ ਜਿਹੀ ਕੋਈ ਵੀ ਕਰੀਮ ਔਡਰ ਨਹੀਂ ਕੀਤੀ ਮੇਰਾ ਬਹੁਤ ਹੀ ਜ਼ਿਆਦਾ ਬੈਡ ਐਕਸਪੀਰੀਅੰਸ ਰਿਹਾ ਆ